ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਮੁੱਖ ਸੱਭਿਆਚਾਰ ਵੀ ਵੱਖੋ ਵੱਖਰਾ ਹੁੰਦਾ ਹੈ ਪੰਜਾਬ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿੱਤੇ ਰਸਮ ਰਿਵਾਜ਼ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਕੀਮਤਾਂ ਮਨੋਰੰਜਨ ਦੇ ਸਾਧਨ ਲੋਕ ਸਾਹਿਤ ਆਦਿ ਸ਼ਾਮਿਲ ਹੁੰਦੇ ਹਨ ਇੱਕ ਨਜ਼ਰ ਦੇਖਿਆ ਜਾਵੇ ਤਾਂ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਲ ਵਰਤਾਰਾ ਹੈ ਅਸਲ ਵਿੱਚ ਕੋਈ ਵੀ ਕੌਮਾਂ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਲ ਜਾਣਿਆ ਜਾਂਦਾ ਹੈ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ ਜਿਸ ਤਰ੍ਹਾਂ ਇਹਨਾਂ ਦਾ ਸੱਭਿਆਚਾਰ ਮੁੱਖ ਸੱਭਿਆਚਾਰਕ ਵੱਖੋ ਵੱਖਰਾ ਹੁੰਦਾ ਹੈ ਉਸੇ ਤਰ੍ਹਾਂ ਇਹਨਾਂ ਦਾ ਸਮਾਜਿਕ ਜੀਵਨ ਦਾ ਢੰਗ ਵੀ ਵੱਖਰਾ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਜਿਵੇਂ ਕਿ ਲਾ ਲਈਏ ਮਾਝਾ ਮਾਲਵਾ ਦੁਆਬਾ ਇਹਨਾਂ ਖੇਤਰਾਂ ਵਿੱਚ ਇਹਨਾਂ ਦੀ ਭਾਸ਼ਾ ਵੱਖੋ ਵੱਖਰੀ ਹੈ ਇਹਨਾਂ ਦਾ ਰਹਿਣ ਸਹਿਣ ਦਾ ਢੰਗ ਵੱਖੋ ਵੱਖਰਾ ਹੈ ਇਹਨਾਂ ਦਾ ਕੱਪੜੇ ਪਹਿਨਣ ਦਾ ਢੰਗ ਵੱਖੋ ਵੱਖਰਾ ਹੈ ਉਸੇ ਤਰ੍ਹਾਂ ਹੀ ਇਹਨਾਂ ਦਾ ਸਮਾਜਿਕ ਜੀਵਨ ਵਿੱਚ ਵੀ ਅੰਤਰ ਆ ਜਾਂਦੇ ਆ ਸਮਾਜ ਵਿੱਚ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਅਤੇ ਮਨੋਰੰਜਨ ਕਰਨ ਦਾ ਵੀ ਸਾਧਨ ਇਹਨਾਂ ਦਾ ਵੱਖੋ ਵੱਖਰਾ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਇਹਨਾਂ ਦੇ ਸਮਾਜਿਕ ਅੰਤਰ ਵੀ ਵੱਖੋ ਵੱਖਰੇ ਹੋ ਜਾਂਦੇ ਹਨ